ਭਾਰਤ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਹਨ ਜਿਵੇਂ ਕਿ ਕਾਂਗਰਸ ਹੋ ਗਈ ਕਾਂਗਰਸ ਦੇ ਰਾਹੁਲ ਗਾਂਧੀ ਜੀ ਹੋ ਗਏ ਆਮ ਆਦਮੀ ਪਾਰਟੀ ਹੁਣ ਆਪ ਨਵੀਂ ਪਾਰਟੀ ਚੱਲੀ ਹੈ ਆਮ ਆਦਮੀ ਪਾਰਟੀ ਹੋ ਗਈ ਇੱਕ ਬੀਜੇਪੀ ਹੋ ਗਈ ਮੁੱਖ ਜਿਵੇਂ ਬੀਜੇਪੀ ਦੇ ਮੋਦੀ ਜੀ ਹੋ ਗਏ ਅਤੇ ਸਾਰੀਆਂ ਪਾਰਟੀਆਂ ਵਿੱਚ ਬਹੁਤ ਜਿਵੇਂ ਕੰਪੀਟੀਸ਼ਨ ਹੀ ਚੱਲ ਰਿਹਾ ਅੱਜ ਕੱਲ੍ਹ ਸਾਰੇ ਹੀ ਕੰਮ ਕਰਵਾਉਣ ਸਭ ਨੂੰ ਐਵੇਂ ਹੋ ਰਿਹਾ ਕਿ ਅਸੀਂ ਵੀ ਆਹ ਕੰਮ ਕਰਾਈਏ ਕੋਈ ਬਿਜਲੀ ਦਾ ਬਿੱਲ ਮਾਫ ਕਰ ਰਿਹਾ ਕੋਈ ਨੌਕਰੀਆਂ ਕੱਢ ਰਿਹਾ ਕੋਈ ਮਕਾਨ ਬਣਾਉਣ ਵਾਸਤੇ ਲੋਕਾਂ ਨੂੰ ਪੈਸੇ ਦੇ ਰਿਹਾ ਹੈਗਾ ਕੋਈ ਮੁਫਤ ਇਲਾਜ ਦੀ ਸਕੀਮ ਚਲਾ ਰਹੀ ਹੈ ਕੋਈ ਸਰਕਾਰ ਜਿਵੇਂ ਜਦੋਂ ਵੋਟਾਂ ਪੈਂਦੀਆਂ ਲੋਕਤੰਤਰ ਹੈ ਆਪਣਾ ਭਾਰਤ ਦੇਸ਼ ਇਹਦੀ ਆ ਆਹ ਬਹੁਤ ਵਧੀਆ ਚੀਜ਼ ਹੈ ਕਿ ਆਪਾਂ ਨੂੰ ਆਪਣਾ ਵੋਟ ਪਾਉਣ ਦਾ ਹੱਕ ਹੈਗਾ ਆਪਾਂ ਆਪਦੀ ਮਰਜ਼ੀ ਨਾਲ ਆਪਦਾ ਉਮੀਦਵਾਰ ਚੁਣ ਸਕਦੇ ਹਾਂ ਆਪਦੀ ਮਰਜ਼ੀ ਨਾਲ ਆਪਾਂ ਨੂੰ ਜਿਹੜਾ ਵੀ ਪਸੰਦ ਹੈ ਆਪਾਂ ਉਹਨੂੰ ਵੋਟ ਪਾ ਸਕਦੇ ਹੈਗੇ ਆ ਜਿਹੜਾ ਵੀ ਆਪਾਂ ਨੂੰ ਚੰਗਾ ਲੱਗਦਾ ਆਪਾਂ ਨੂੰ ਐਂ ਲੱਗਦਾ ਕਿ ਆਹ ਬੰਦਾ ਕੰਮ ਕਰਾਵੇਗਾ ਕੰਮ ਤਾਂ ਸਾਰੇ ਹੀ ਕਰਾ ਰਹੇ ਹਨ ਪਰ ਆਪਾਂ ਨੂੰ ਸਭ ਦੀ ਪਸੰਦ ਅਲੱਗ ਅਲੱਗ ਹੁੰਦੀ ਆ ਆਪਾਂ ਨੂੰ ਜਿਹੜਾ ਵੀ ਚੰਗਾ ਲੱਗਦਾ ਆਪਾਂ ਉਹਨੂੰ ਵੋਟ ਪਾਉਂਦੇ ਹਾਂ ਆਪਾਂ ਨੂੰ ਆਹ ਅਧਿਕਾਰ ਆ ਆਪਾਂ ਨੂੰ ਆ ਸਵਤੰਤਰਤਾ ਭਾਰਤ ਦੇਸ਼ ਵਿੱਚ ਬਾਕੀ ਦੇਸ਼ਾਂ ਤੋਂ ਆਪਣਾ ਦੇਸ਼ ਬਹੁਤ ਵਧੀਆ ਹੈਗਾ ਕਿ ਆਪਾਂ ਨੂੰ ਆਹ ਅਸਵਤੰਤਰਾ ਸਵਤੰਤਰਤਾ ਹੈਗੀ ਹੈ ਆਜ਼ਾਦੀ ਮਿਲੀ ਹੋਈ ਆਪਾਂ ਨੂੰ ਆਹ ਵਾਲੀ ਕਿ ਵੋਟ ਆਪਾਂ ਆਪਦਾ ਹੱਕ ਚੁਣ ਸਕਦੇ ਹਾਂ ਆਪਾਂ ਆਪਦਾ ਵੋਟ ਆਪ ਪਾ ਸਕਦੇ ਹੈਗੇ ਆਪਾਂ ਨੂੰ ਆਜ਼ਾਦੀ ਮਿਲੀ ਹੋਈ ਹੈਗੀ ਆ ਕਈ ਦੇਸ਼ਾਂ ਵਿੱਚ ਤਾਂ ਵੋਟ ਪਾਉਣ ਦਾ ਹੱਕ ਹੀ ਨਹੀਂ ਮਿਲ ਹੁੰਦਾ ਲੋਕਾਂ ਨੂੰ ਅਤੇ ਪਰ ਆਪਣੇ ਦੇਸ਼ ਵਿੱਚ ਆ ਬਹੁਤ ਵਧੀਆ ਗੱਲ ਹੈਗੀ ਹੈ ਕਿ ਆਪਾਂ ਨੂੰ ਆਪ ਦਾ ਨੇਤਾ ਚੁਣਨ ਦੀ ਆਜ਼ਾਦੀ ਹੈਗੀ ਹੈ